ਅੱਜ ਕੱਲ੍ਹ ਦੀਆਂ ਰਸੋਈਆਂ ਦੇ ਵਿੱਚ ਮਿਕਸਰ ਗ੍ਰਾਈਡਰ ਗੈਸ ਸਿਲੰਡਰ ਓਵਨ ਟੋਸਟਰ ਪ੍ਰੈਸ਼ਰ ਕੂਕਰ ਫੂਡ ਪ੍ਰਸੈਸਰ ਬਲੈਂਡਰ ਜੂਸਰ ਅਜਿਹੇ ਕਈ ਆਧੁਨਿਕ ਉਪਕਰਣ ਉਪਲੱਬਧ ਨੇ ਪਹਿਲਾਂ ਤਾਂ ਲੋਕ ਚੁੱਲ੍ਹੇ ਚੌਂਕਿਆਂ ਤੋਂ ਹੀ ਵਿਹਲੇ ਨਹੀਂ ਹੋ ਪਾਂਦੇ ਸਨ ਔਰਤਾਂ ਸਵੇਰ ਤੋਂ ਹੀ ਚੁੱਲ੍ਹਾ ਬਾਲ ਦੇਂਦੀਆਂ ਅਤੇ ਸਾਰਾ ਸਾਰਾ ਦਿਨ ਰਸੋਈ ਦੇ ਕੰਮਾਂ ਦੇ ਵਿੱਚ ਹੀ ਜੁੱਟੀਆਂ ਰਹਿੰਦੀਆਂ ਸਨ ਅਗਰ ਕਿਸੇ ਨੇ ਕੋਈ ਮਸਾਲਾ ਜਾਂ ਚਟਨੀ ਕੁੱਟਣੀ ਤਾਂ ਦੋਰੇ ਡੰਡੇ ਦਾ ਇਸਤੇਮਾਲ ਕਰਨਾ ਮਿਰਚਾਂ ਕੁੱਟਣੀਆਂ ਅਤੇ ਹਮਾਮਦਸਤੇ ਦਾ ਭਾਂਡੇ ਸਾਰਾ ਦਿਨ ਕਾਲੇ ਹੋ ਜਾਣੇ ਧੂੰਆਂ ਬਹੁਤ ਉੱਠਣਾ ਹੁਣ ਲੋਕ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਸਾਰੇ ਕੰਮਾਂ ਨੂੰ ਕਰਕੇ ਪਰਾਂ ਹੋ ਜਾਂਦੇ ਹਨ ਫੂਡ ਪ੍ਰੋਸੈਸਰ ਜਾਂ ਬਲੈਂਡਰ ਦੇ ਨਾਲ ਜਾਂ ਮਿਕਸਰ ਗ੍ਰਾਈਂਡਰਾਂ ਦੇ ਨਾਲ ਮਿੰਟੋਂ ਮਿੰਟੀ ਮਸਾਲੇ ਕੁੱਟੇ ਜਾਂਦੇ ਹਨ ਚਟਨੀਆਂ ਕੁੱਟੀਆਂ ਜਾਂਦੀਆਂ ਹਨ ਅਤੇ ਭਾਂਤ ਭਾਂਤ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ ਪਹਿਲਾਂ ਸਾਗ ਬਣਾਉਣਾ ਇੱਕ ਮਿਸ਼ਨ ਦੇ ਤੌਰ 'ਤੇ ਹੁੰਦਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਗ ਨੂੰ ਚੁੱਲ੍ਹੇ 'ਤੇ ਰੱਖ ਦਿੱਤਾ ਜਾਂਦਾ ਸੀ ਹੁਣ ਪਰ ਪ੍ਰੈਸ਼ਰ ਕੂਕਰਾਂ ਦੇ ਨਾਲ ਇਹ ਸਮੇਂ ਦੀ ਬਰਬਾਦੀ ਨੂੰ ਬਚਾਇਆ ਜਾਂਦਾ ਹੈ ਹਰ ਕੰਮ ਨੂੰ ਸੌਖਾ ਕਰ ਦਿੱਤਾ ਹੈ ਆਧੁਨਿਕ ਉਪਕਰਨਾਂ ਨੇ